ਮੈਨੂੰ ਇਹ ਲੱਗਦਾ ਹੈ ਕਿ ਖਬਰ ਉਦਯੋਗ ਬੋਲਣ ਦੀ ਆਜ਼ਾਦੀ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਆਜ਼ਾਦੀ ਦੇਣ ਕਰਕੇ ਲੋਕਾਂ ਤੇ ਬਹੁਤ ਗਲਤ ਪ੍ਰਭਾਵ ਪਾਊਗਾ ਅਤੇ ਬੱਚਿਆਂ ਤੇ ਵੀ ਬਹੁਤ ਗਲਤ ਪ੍ਰਭਾਵ ਪਊਗਾ ਜੋ ਕਿ ਚੰਗੀ ਗੱਲ ਨਹੀਂ ਹੈ ਲੋਕ ਇਸ ਚੀਜ਼ਾਂ ਤੋਂ ਬਹੁਤ ਗਲਤ ਸਿੱਖਦੇ ਹਨ ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਜਾਣਕਾਰੀ ਨੂੰ ਗੁਪਤ ਹੀ ਰੱਖਣਾ ਚਾਹੀਦਾ ਹੈ ਇਸ ਅੱਜ ਕੱਲ ਲੋਕਾਂ ਨੇ ਯੂਟੀਊਬ ਚੈਨਲ ਰਾਹੀਂ ਆਪਣੇ ਚੈਨਲ ਖੋਲੇ ਹਨ ਜਿਨਾਂ ਕਰਕੇ ਬਹੁਤ ਲੋਕਾਂ ਤੇ ਵੀ ਗਲਤ ਪ੍ਰਭਾਵ ਪਿਆ ਹੈ ਜੋ ਕਿ ਸਾਡੀ ਲੋਕਾਂ ਲਈ ਚੰਗਾ ਨਹੀਂ ਹੈ